ਮੈਂ ਛੋਟੇ ਹੁੰਦੇ ਤੋਂ ਹੀ ਪ੍ਰੇਮ ਨਗਰ 'ਤੇ ਰਹਿੰਦੀ ਹਾਂ ਅਤੇ ਸਾਡੇ ਪਿੰਡ ਵਿੱਚ ਮਤਲਬ ਪਿਛਲੇ ਸਾਲ ਤੋਂ ਜ਼ਿਆਦਾ ਇਸ ਬਾਰ ਦੁਕਾਨਾਂ ਖੁੱਲ ਗਈਆਂ ਅਤੇ ਮਤਲਬ ਜਿਹੜੀ ਮਤਲਬ ਇਸ ਸਾਲ ਤਾਂ ਮਤਲਬ ਵੀਹ ਪੰਦਰ੍ਹਾਂ ਦੁਕਾਨਾਂ ਹੈਗੀਆਂ ਆ ਸਾਡੇ ਪਿੰਡ 'ਚ ਅਤੇ ਜਿਹੜੀ ਮੇਰੇ ਘੜਦੇ ਘਰਦੇ ਨੇੜੇ ਹੈ ਦਕਾਨ ਉਹ ਸੀਤਾ ਰਾਮ ਦੀ ਦੁਕਾਨ ਆ ਅਸੀਂ ਉੱਥੇ ਤੋਂ ਸਾਰਾ ਸਮਾਨ ਲੈਂਦੇ ਹੈ ਅਤੇ ਬਹੁਤ ਵਧੀਆ ਦਿੰਦੇ ਉਹ ਸਮਾਨ ਕੁਆਲਿਟੀ ਵੀ ਬਹੁਤ ਵਧੀਆ ਹੁੰਦੀ ਹੈ ਅਤੇ ਅਸੀਂ ਮਤਲਬ ਵਾਧਾ ਘਾਟਾ ਵੀ ਕਰਾ ਸਕਦੇ ਹਾਂ ਮਤਲਬ ਪੈਸੇ ਤੋਂ ਅਤੇ ਅਸੀਂ ਜਿਦਾਂ ਹੁਣ ਪੈਸਾ ਵੀ ਨਹੀਂ ਦਿੰਦੇ ਮਤਲਬ ਬਾਅਦ 'ਚ ਦਿੰਦੇ ਹੈ ਅਤੇ ਉਹ ਮਤਲਬ ਬਹੁਤ ਵਧੀਆ ਹੈ ਮਤਲਬ ਉੱਥੇ ਮਤਲਬ ਹਰ ਚੀਜ਼ ਮਿਲਦਾ ਜਿਵੇਂ ਕਿ ਸਬਜ਼ੀ ਵਗੈਰਾ ਲੈ ਲਓ ਅਤੇ ਫੋਰਚੂਨ ਦਾ ਜਿਵੇਂ ਰਾਸ ਅੰਦਰ ਸਮਾਨ ਵੀ ਲੈ ਸਕਦੇ ਐਂ ਅਤੇ ਸਾ ਚੂੜੀਆਂ ਵਗੈਰਾ ਵੀ ਲੈ ਸਕਦੇ ਹੈ ਅਤੇ ਬਹੁਤ ਹੀ ਵਧੀਆ ਹੁੰਦੀ ਆ ਉੱਥੇ ਦੀ ਸਮਾਨ ਅਤੇ ਅਸੀਂ ਦੂਜਿਆਂ ਨੂੰ ਵੀ ਕਹਿੰਦੇ ਆ ਮਤਲਬ ਉੱਥੇ ਜਾਵੇ ਉੱਥੇ ਤੋਂ ਪਰਚੇਜ਼ ਕਰੇ ਬਹੁਤ ਹੀ ਵਧੀਆ ਹੁੰਦੀ ਹੈ ਅਸੀਂ ਉੱਤੇ ਤੋਂ ਹੀ ਸਭ ਲੈਂਦੇ ਐਂ